ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਜੀ ਫੋਟੋਗ੍ਰਾਫੀ ਦਾ ਸ਼ੌਕ ਰੱਖਦਾ ਸੀਗਾ ਜਦੋਂ ਮੈਂ ਛੋਟਾ ਸੀਗਾ ਅਤੇ ਉਦੋਂ ਮੈਂ ਨੈਸ਼ਨਲ ਜਗਰਾਫਿਕ ਵੇਖਦਾ ਸੀਗਾ ਅਤੇ ਉਸ ਟਾਈਮ ਦੇ ਵਿੱਚ ਕੈਵਨ ਪੀਟਰਸਨ ਨਾਮ ਦਾ ਇੱਕ ਗੋਰਾ ਉਹ ਇੱਕ ਵਰਡ ਲਾਈਫ ਫੋਟੋਗ੍ਰਾਫਰ ਸੀਗਾ ਅਤੇ ਉਹ ਬਹੁਤ ਹੀ ਸੋਹਣੀਆਂ ਜੰਗਲ ਦੇ ਵਿੱਚ ਜਾ ਕੇ ਸ਼ੇਰਾਂ ਦੇ ਨਾਲ ਫੋਟੋ ਕਲਿੱਕ ਕਰਦਾ ਸੀਗਾ ਮੈਂ ਉਸ ਟੇ ਉਸ ਸਮੇਂ ਛੋਟਾ ਬੱਚਾ ਹੋਣ ਮੇਰਾ ਸ਼ੌਕ ਸੀਗਾ ਇੱਕ ਕਿ ਮੈਂ ਇੱਕ ਵਰਡ ਲਾਈਫ ਫੋਟੋਗ੍ਰਾਫਰ ਬਣਾ ਅਤੇ ਉਸ ਤੋਂ ਬਾਅਦ ਜਿਉਂ ਜਿਉਂ ਵੱਡਾ ਹੁੰਦਾ ਗਿਆ ਅਤੇ ਮੈਂ ਜਾਨਵਰ ਪ੍ਰਤੀ ਪ੍ਰਤੀ ਮੇਰਾ ਫੁੱਲ ਲਗਾਓ ਹੁੰਦਾ ਗਿਆ ਅਤੇ ਮੈਂ ਬਹੁਤ ਸ਼ੌਕ ਸੀਗਾ ਕਿ ਮੈਂ ਇੱਕ ਵਾਈਲਡ ਲਾਈਫ ਫੋਟੋਗ੍ਰਾਫਰ ਬਣਾ ਬਟ ਕੁਝ ਮੁਸ਼ ਮੁਸ਼ਕਿਲਾਂ ਦੇ ਕਰਕੇ ਮੈਂ ਫੋਟੋਗ੍ਰਾਫਰ ਵਲਡ ਲਾਈਫ ਫੋਟੋਗ੍ਰਾਫਰ ਨਹੀਂ ਬਣ ਪਾਇਆ ਅੱਜ ਕੱਲ੍ਹ ਵਿਆਹ ਦੇ ਵਿੱਚ ਪ੍ਰੀ ਵੈਡਿੰਗ ਪ੍ਰੀ ਵੈਡਿੰਗ ਸ਼ੂਟ ਅੰਗੇਜਮੈਂਟ ਅਤੇ ਥਾਕੇ ਅਤੇ ਵਿਆਹ 'ਤੇ ਬਹੁਤ ਸਾਰੇ ਸ਼ੂਟ ਚਲਦੇ ਹੀ ਰਹਿੰਦੇ ਆ ਫੋਟੋਗ੍ਰਾਫੀ ਇੱਕ ਬਹੁਤ ਵੱਡਾ ਆਰਟ ਆ ਇੱਕ ਟੈਲੈਂਟ ਆ ਜਿਹੜਾ ਬੰਦੇ ਦੇ ਵਿੱਚ ਕੁਝ ਕੁ ਇਨਸਾਨਾਂ ਦੇ ਵਿੱਚ ਪਾਇਆ ਜਾਂਦਾ ਹੈਗਾ ਕਿਸ ਢੰਗ ਨਾਲ ਸ਼ੂਟ ਕਰਨਾ ਕਿਸ ਸਾ ਢੰਗ ਦੇ ਨਾਲ ਫੋਟੋ ਖਿੱਚਣੀ ਉਹ ਕਿਸ ਐਂਗਲ 'ਚ ਖਿੱਚਣੀ ਕਿਸ ਐਂਗਲ 'ਚ ਬੰਦਾ ਸਹੀ ਦਿਖ ਰਿਹਾ ਆ ਇਹ ਬਹੁਤ ਵੱਡੀ ਇੱਕ ਕਲਾ ਆ ਇਹ ਫਨਕਾਰ ਬੰਦਾ ਹੀ ਕਰ ਸਕਦਾ ਅਦਰਵਾਈਜ ਇਹ ਕੋਈ ਨੋਰਮਲ ਬੰਦੇ ਦੇ ਵੱਸ ਦਾ ਕੰਮ ਨਹੀਂ ਹੈਗਾ ਕਿ ਇਹ ਕੋਈ ਕ ਕਰ ਸਕੇ ਬਾਕੀ ਤਾਂ ਮੇਰੇ ਸਾਰੇ ਨੂੰ ਆਏਈ ਇੱਕ ਵਾਰੀ ਵਲਡ ਲਾਈਫ ਫੋਟੋਗਰਾਫਰ ਬਣ ਕੇ ਜ਼ਰੂਰ ਦੇਖਿਆ ਜਾਵੇ